ਮੈਂ ਦਸ ਦਿਨ ਪਹਿਲਾਂ ਜੈਕੇਟ ਔਡਰ ਕੀਤੀ ਸੀ ਜਿਹੜੀ ਸਾਨੂੰ ਕੱਲ੍ਹ ਮਿਲ ਗਈ ਅਤੇ ਜਾਕਟ ਦੀ ਪੈਕਿੰਗ ਵੀ ਵਾਟਰਪਰੂਫ ਕੀਤੀ ਸੀ ਤੁਸੀਂ ਅਤੇ ਜਦੋਂ ਅਸੀਂ ਪੈਕਿੰਗ ਖੋਲ੍ਹੀ ਅੰਦਰੋਂ ਵੀ ਬੜੀਆ ਵਧੀਆ ਜਾਕਟ ਨਿਕਲੀ ਕਾਲੇ ਰੰਗ ਦੀ ਅਤੇ ਜਿਹੜੇ ਬੇਟੇ ਨੂੰ ਪਾ ਕੇ ਬੜਾ ਵਧੀਆ ਲੱਗਿਆ ਉਹ ਵੀ ਬੜਾ ਖੁਸ਼ ਹੈ ਬੜਾ ਸ਼ੁਕਰਗੁਜ਼ਾਰ ਹੈ ਅਤੇ ਮੈਂ ਵੀ ਆਪਣੀ ਜਾਕਟ ਫਲਿੱਪਕਾਟ ਤੋਂ ਕ ਔਡਰ ਕਰ ਦਿੱਤੀ ਹੈ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ